ਤਕਨੋਲਜੀ ਨਵੀਂ ਤਕਨੀਕ ਨਾਲ ਅਸੀਂ ਆਪਣੇ ਮੋਬਾਈਲ ਤੋਂ ਮਿੰਟਾਂ ਸਕਿੰਟਾਂ ਵਿੱਚ ਪੈਸੇ ਭੇਜ ਸਕਦੇ ਹਾਂ ਅਤੇ ਅਲੱਗ ਅਲੱਗ ਐਪ ਦੀ ਵਰਤੋਂ ਕਰਕੇ ਆਪਣੇ ਸਟਾਫ ਅਤੇ ਗਾਹਕਾਂ ਨੂੰ ਮੈਨੇਜ ਕਰ ਸਕਦੇ ਹਾਂ